ਸਾਡਾ ਕੰਸਟਰਕਸ਼ਨ ਲਾਈਨ ਦਾ ਕੰਮ ਹੈ ਜਿਸ ਵਿੱਚ ਹਰ ਜਾਤੀ ਹਰ ਧਰਮ ਅਤੇ ਵੱਖ ਵੱਖ ਰਾਜਾਂ ਦੇ ਬੰਦੇ ਕੰਮ ਕਰਦੇ ਹਨ ਸਾਰੇ ਵਰਕਰ ਬਹੁਤ ਹੀ ਪਿਆਰ ਦੇ ਨਾਲ ਰਹਿੰਦੇ ਹਨ ਵੱਖ ਵੱਖ ਧਰਮਾਂ ਦਾ ਹੋਣ ਦੇ ਕਾਰਨ ਅਤੇ ਵੱਖ ਵੱਖ ਰਾਜਾਂ ਤੋਂ ਹੋਣ ਦੇ ਕਾਰਨ ਹਰ ਇੱਕ ਵਰਕਰ ਨੂੰ ਇੱਕ ਦੂਸਰੇ ਦੇ ਧਰਮ ਬਾਰੇ ਅਤੇ ਇੱਕ ਦੂਸਰੇ ਦੇ ਰਾਜਾਂ ਬਾਰੇ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਹੈ ਜਿਸ ਨਾਲ ਇਨ ਇਹਨਾਂ ਦੇ ਆਪਸੀ ਵਿਚਾਰਕ ਮਤਭੇਦ ਦੂਰ ਹੁੰਦੇ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪੈਂਦਾ ਹੈ ਸਾਰੇ ਵਰਕਰਾਂ ਸਾਰੇ ਵਰਕਰਾਂ ਨੂੰ ਸਮਾਨ ਟ੍ਰੀਟ ਕੀਤਾ ਜਾਂਦਾ ਹੈ ਜਿਸ ਨਾਲ ਇਹਨਾਂ ਨੂੰ ਸ ਇਹਨਾਂ ਅੰਦਰ ਸਮਾਨਾਰਥਕ ਬੀ ਦਾ ਪੈਦਾਵਾਰ ਹੁੰਦੀ ਹੈ ਇਹਨਾਂ ਇਹਨਾਂ ਵਰਕਰਾਂ ਦੀ ਸੋਸ਼ਲ ਲਾਈਫ ਵੀ ਬਹੁਤ ਇਮਪਰੂਵ ਹੁੰਦੀ ਹੈ ਤਾਂ ਜੋ ਇਹ ਹੋਰ ਧਰਮਾਂ ਦੇ ਲੋਕਾਂ ਨੂੰ ਅਤੇ ਆਊਟਸਾਈਡਰਸ ਨੂੰ ਅਸੈਪਟ ਕਰ ਸਕਣ ਅਤੇ ਇਕੱਠੇ ਰਲ ਮਿਲ ਕੇ ਰਹਿ ਸਕਣ ਇਹ ਵਰਕਰ ਦੇਸ਼ ਦੀ ਇਕਨੋਮਿਕ ਡਿਵੈਲਪਮੈਂਟ ਵਿੱਚ ਵੀ ਬਹੁਤ ਯੋਗਦਾਨ ਪਾਉਂਦੇ ਹਨ ਤਨਖਾਹ ਦੇ ਮਿਲੇ ਹੋਏ ਪੈਸੇ ਇਹ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਂਦੇ ਹਨ